ਪੰਜਾਬ ਵਿੱਚ ਮਾਨਸਿਕ ਸਿਹਤ ਦੇ ਬਹੁਤ ਸਾਰੇ ਉਪਲਬਧ ਸ੍ਰੋਤ ਉਪਲਬਧ ਹਨ ਜਿਵੇਂ ਕਿ ਕਈ ਤਰ੍ਹਾਂ ਦੇ ਹੋਸਪਿਟਲ ਹਨ ਜੋ ਕਿ ਸਪੈਸ਼ਲ ਹੀ ਮਾਨਸਿਕ ਜਿਹੜੀ ਬਿਮਾਰੀਆਂ ਨੂੰ ਠੀਕ ਕਰਦੇ ਹਨ ਇਸ ਦੇ ਵਿੱਚ ਜੋ ਇੱਕ ਪੇਸ਼ੈਂਟ ਹੈ ਮਰੀਜ਼ ਹੈ ਉਹ ਆਪਣੀ ਜੋ ਪ੍ਰੋਬਲਮ ਹੈ ਉਹ ਦੱਸ ਸਕਦਾ ਹੈ ਜਿਵੇਂ ਕਿ ਡਿਪਰੈਸ਼ਨ ਹੋ ਗਿਆ ਡਿਪਰੈਸ਼ਨ ਅੱਜ ਕੱਲ੍ਹ ਬਹੁਤ ਜ਼ਿਆਦਾ ਯੂਥ ਦੇ ਵਿੱਚ ਚੱਲ ਰਹੀ ਹੈ ਇਸ ਦੀ ਵੀ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਮਿਲਦੀਆਂ ਹਨ ਅਤੇ ਬਹੁਤ ਸਾਰੇ ਇਹਦੇ ਸੈਂਟਰ ਬਣੇ ਹੋਏ ਹਨ